ਅਕਸਰ ਪਿੰਡਾਂ ਵਿੱਚ ਜਦੋਂ ਵਿਆਹ ਹੁੰਦੇ ਹਨ ਤਾਂ ਔਰਤਾਂ ਗਿੱਧਾ ਪਾ ਕੇ ਤਮਾਸ਼ੇ ਕਰਦੀਆਂ ਹਨ ਤਾਂ ਇਹਨਾਂ ਸੰਬੰਧੀ ਕਈ ਔਰਤਾਂ ਇਸ ਵਿੱਚ ਬਹੁਤ ਮਸ਼ਹੂਰ ਹੁੰਦੀਆਂ ਹਨ ਉਹਨਾਂ ਦਾ ਨਾਮ ਉਸ ਨਾਂ ਨਾਲ ਜਾਣਿਆ ਜਾਣ ਲੱਗ ਜਾਂਦਾ ਹੈ ਇਹ ਔਰਤਾਂ ਗਿੱਧੇ ਵਿੱਚ ਤਮਾਸ਼ੇ ਕਰਦੀਆਂ ਹਨ ਅਤੇ ਨਾਟਕ ਕਰਦੀਆਂ ਹਨ ਇਸ ਸੰਬੰਧੀ ਸਾਡੇ ਪਿੰਡ ਵਿੱਚ ਇੱਕ ਔਰਤ ਹੈ ਜੋ ਹਮੇਸ਼ਾਂ ਗਿੱਧੇ ਵਿੱਚ ਬਹੁਤ ਜ਼ਿਆਦਾ ਖੱਪ ਖਾਨਾ ਪਾਉਂਦੀ ਹੈ ਇਸ ਨਾਲ ਸੰਬੰਧਿਤ ਉਹ ਬਹੁਤ ਮਸ਼ਹੂਰ ਹੈ ਉਸਨੂੰ ਨਾਲ ਦੇ ਪਿੰਡਾਂ ਵਿੱਚ ਵੀ ਗਿੱਧੇ ਲਈ ਸੱਦਿਆ ਜਾਂਦਾ ਹੈ ਅਤੇ ਤਮਾਸ਼ੇ ਕਰਨ ਲਈ ਸੱਦਿਆ ਜਾਂਦਾ ਹੈ